ਪੰਜਾਬ ਵਿੱਚ ਮਸ਼ਹੂਰ ਨਾਚ ਸ਼ੈਲੀ ਭੰਗੜਾ ਜਿੱਦਾਂ ਕਿ ਪੰਜਾਬ ਦਾ ਮਸ਼ਹੂਰ ਹੈ ਨਾਚ ਹੈ ਕਥਕ ਕਲੀ ਹੋ ਗਿਆ ਕੇਰਲ ਦਾ ਪੋਂਗਲ ਤਾਮਿਲਨਾਡੂ 'ਚ ਕਿੱਕਲੀ ਪੰਜਾਬ 'ਚ ਅਤੇ ਜਿਹੜੀ ਲੁੱਡੀ ਹੈ ਉਹ ਹਿਮਾਚਲ ਦੀ ਹੋ ਗਈ ਗਰਬਾ ਗੁਜਰਾਤ 'ਚ ਝੁਮਰ ਰਾਜਸਥਾਨ 'ਚ ਨੌਟੰਕੀ ਉੱਤਰ ਪ੍ਰਦੇਸ਼ ਦੀ ਇਹ ਸਾਰੇ ਜਿਹੜੇ ਲੋਕ ਨਾਚ ਨੇ ਉਹ ਭਾਰਤ ਵਿੱਚ ਬਹੁਤ ਹੀ ਮਸ਼ਹੂਰ ਨੇ ਅਤੇ ਜੇ ਆਪਾਂ ਗੱਲ ਕਰੀਏ ਮਸ਼ਹੂਰ ਡਾਂਸਰ ਦੀ ਅੱਜ ਕੱਲ੍ਹ ਤਾਂ ਇੱਕੋ ਹੀ ਡਾਂਸਰ ਦਾ ਨਾਮ ਚੱਲ ਰਿਹਾ ਜੋ ਬੜੀ ਮਸ਼ਹੂਰ ਹੈ ਸਪਨਾ ਚੋਧਰੀ